ਹੈਲੋ ਹਾਂਜੀ ਕਸਟਮਰ ਪੈਨ ਕੇਡ ਸੈਂਟਰ ਤੋਂ ਗੱਲ ਕਰ ਰਹੇ ਹੋ ਸਰ ਸਰ ਇਸ ਤਰਾਂ ਹੈ ਕਿ ਮੇਰਾ ਇ ਪੈਨ ਕਾਰਡ ਮਿਸਪਲੇਸ ਹੋ ਗਿਆ ਅਤੇ ਮੈਂ ਆਪਣੀ ਜੋਬ ਲਈ ਇੰਟਰਵਿਊ ਵਾਸਤੇ ਜਾਣਾ ਅਤੇ ਮੈਨੂੰ ਉਹਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤਾਂ ਪਲੀਜ਼ ਤੁਸੀਂ ਕਿਸੇ ਵੀ ਤਰ੍ਹਾਂ ਨਾਲ ਮੈਨੂੰ ਉਹ ਦੁਬਾਰਾ ਸੋਫਟ ਕਾਪੀ ਦੇ ਰੂਪ ਵਿੱਚ ਹੀ ਭਾਵੇਂ ਪ੍ਰੋਵਾਈਡ ਕਰਵਾ ਦਿਓ ਇੱਕ ਵਾਰੀ ਤਾਂ ਕਿ ਮੈਂ ਇੰਟਰਵਿਊ ਕਲੀਅਰ ਕਰ ਸਕਾਂ ਤੁਹਾਨੂੰ ਮੈਂ ਆਪਣਾ ਪੈਨ ਕਾਰਡ ਨੰਬਰ ਦੇ ਦਿੰਦਾ ਮੇਰਾ ਪੈਨ ਕਾਰਡ ਨੰਬਰ ਹੈ ਸਿਕਸ ਏਟ ਫੋਰ ਜ਼ੀਰੋ ਬੀ ਸੀ ਪੀ ਆਰ ਕੇ ਨਾਈਨ ਤਾਂ ਜਲਦੀ ਤੋਂ ਜਲਦੀ ਤੁਸੀਂ ਜਿੰਨਾ ਕਰਵਾ ਸਕੋ ਤਾਂ ਮੈਂ ਆਪਣੀ ਇੰਟਰਵਿਊ ਲਈ ਜਾ ਸਕਦਾ ਤਾਂ ਪਲੀਜ਼ ਅਗਰ ਹੋ ਸਕੇ ਤਾਂ ਤੁਸੀਂ ਦੋ ਦਿਨਾਂ ਦੇ ਵਿੱਚ ਅਗਰ ਕਰਵਾ ਸਕਦੇ ਹੋ ਤਾਂ ਬਹੁਤ ਵਧੀਆ ਰਹੇਗਾ ਕਿਉਂਕਿ ਮੇਰਾ ਤੀਸਰੇ ਦਿਨ ਇੰਟਰਵਿਊ ਹੈ ਇਸ ਚੀਜ਼ ਦਾ ਅਤੇ ਮੈਂ ਆਪਣੀ ਜੋਬ ਦੀ ਸਲੈਕਸ਼ਨ ਦੀ ਉਮੀਦ ਰੱਖਣਾ ਇਸ ਤੋਂ ਤੋਂ ਤੁਹਾਡੀ ਜ਼ਰੂਰਤ ਬੜੀ ਹੈ ਤੁਹਾਡੀ ਹੈਲਪ ਦੀ ਬਹੁਤ ਲੋੜ ਪਵੇਗੀ ਸਰ ਮੈਨੂੰ ਪਲੀਜ਼ ਆ ਪ੍ਰੋਵਾਈਡ ਕਰਵਾ ਦਿਓ ਤੁਸੀਂ ਤੁਹਾਡੇ ਜੋ ਵੀ ਫੀਸ ਬਣਦੀ ਹੈ ਮੈਂ ਤੁਹਾਨੂੰ ਪੇ ਕਰ ਦਿਆਂਗਾ ਤੁਸੀਂ ਮੈਨੂੰ ਮੈਸੇਜ ਸੈਂਡ ਕਰ ਦੇਣਾ ਮੈਂ ਤੁਹਾਨੂੰ ਗੂਗਲ ਪੇ ਦੇ ਥਰੂ ਕਰ ਦਿਆਂਗਾ ਜਾਂ ਜਿਸ ਵੀ ਤਰ੍ਹਾਂ ਦਾ ਮੇਰੇ ਕੋਲ ਹੋ ਸਕੇ ਮੈਂ ਤੁਹਾਨੂੰ ਤੁਹਾਡੀ ਫੀਸ ਨਾਲ ਦੀ ਨਾਲ ਤੁਹਾਨੂੰ ਪੇ ਕਰ ਦਿਆਂਗਾ ਤਾਂ ਤੁਸੀਂ ਪਲੀਜ਼ ਮੇਰਾ ਪੈਨ ਕਾਰਡ ਮੈਨੂੰ ਪ੍ਰੋਵਾਈਡ ਕਰਵਾ ਦਿਓ ਸੋਫਟ ਕਾਪੀ ਦੇ ਥਰੂ ਥੈਂਕ ਯੂ